ਦੇਖੋ ਹਸਪਤਾਲ ਪ੍ਰਬੰਧਨ ਬਾਰੇ ਮੇਰੀ ਰਾਏ ਇਹ ਹੈ ਸਾਡੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਸਿਵਲ ਹੋਸਪਿਟਲ ਹੈ ਉਹ ਬਹੁਤ ਜ਼ਿਆਦਾ ਵੱਡਾ ਅਤੇ ਬਹੁਤ ਹੀ ਜ਼ਿਆਦਾ ਕਹਿਣ ਦਾ ਭਾਵ ਵਧੀਆ ਹੋਸਪਿਟਲ ਹੈ ਉਹਦੇ 'ਚ ਹਰ ਤਰ੍ਹਾਂ ਦੀ ਸਹੂਲਤ ਹੈ ਦਵਾਈਆਂ ਮੁਫਤ ਦਵਾਈਆਂ ਮੁਫਤ ਇਲਾਜ ਹੁੰਦਾ ਉੱਥੇ ਅਤੇ ਡਾਕਟਰਾਂ ਦੀ ਟੀਮ ਹਰ ਟਾਈਮ ਉੱਥੇ ਤਿਆਰ ਰਹਿੰਦੀ ਆ ਬਹੁਤ ਹੀ ਸ ਵਧੀਆ ਸਟਾਫ ਹੈ ਆਏ ਗਏ ਮਰੀਜ਼ ਨੂੰ ਚੰਗੀ ਤਰ੍ਹਾਂ ਦੇਖਦੇ ਹਨ ਸਾਡੇ ਪਿੰਡ ਡਿਸਪੈਂਸਰੀ ਆ ਡਿਸਪੈਂਸਰੀ ਦੇ ਵਿੱਚ ਕਦੇ ਕਦੇ ਡਾਕਟਰਾਂ ਦੀ ਘਾਟ ਮਹਿਸੂਸ ਹੁੰਦੀ ਆ ਅਤੇ ਸਮੇਂ ਸਿਰ ਇਲਾਜ ਨਹੀਂ ਹੋ ਪਾਉਂਦਾ ਇਸ ਲਈ ਸਾਨੂੰ ਫਤਿਹਗੜ੍ਹ ਸਾਹਿਬ ਆਉਣਾ ਪੈਂਦਾ ਇੱਥੇ ਹਰ ਤਰ੍ਹਾਂ ਦੀ ਸਹੂਲਤ ਹਰ ਤਰ੍ਹਾਂ ਦਾ ਸਟਾਫ ਵਧੀਆ ਡਾਕਟਰ ਮਿਲਦੇ ਨੇ ਅਤੇ ਮੁਫਤ ਦਵਾਈਆਂ ਮੁਫਤ ਹੀ ਇਲਾਜ ਹੁੰਦਾ ਹੈ